ਮੈਂ ਰੋਜ਼ ਸਵੇਰੇ ਉੱਠ ਕੇ ਸਾਈਕਲ ਨੂੰ ਚਲਾਉਂਦਾ ਹਾਂ ਅਤੇ ਇਸਦੀ ਦੇਖਭਾਲ ਕਰਨ ਦੇ ਲਈ ਮੈਂ ਰੋਜ਼ ਇਸ ਦੀ ਇੱਕ ਤਾਂ ਹਵਾ ਚੈੱਕ ਕਰਦਾ ਹਾਂ ਅਤੇ ਰੋਜ਼ ਇਸ ਦੇ ਉੱਤੇ ਕੱਪੜਾ ਫੇਰਦਾ ਹਾਂ ਤਾਂ ਜੋ ਇਹ ਸਾਫ਼ ਸੁਥਰਾ ਦਿਖੇ ਜਦੋਂ ਮੈਨੂੰ ਇਹ ਕਿਤੇ ਗੰਦਾ ਲੱਗਦਾ ਹੈ ਤਾਂ ਮੈਂ ਸਰਫ ਨਾਲ ਅਤੇ ਸੈਂਪੂ ਨਾਲ ਇਸ ਨੂੰ ਧੋ ਵੀ ਦਿੰਦਾ ਹਾਂ ਸਾਈਕਲ ਚਲਾਉਣਾ ਕਦੇ ਕਦੇ ਥਕਾਵਟ ਭਰਿਆ ਵੀ ਲੱਗਦਾ ਹੈ ਪਰੰਤੂ ਜਦੋਂ ਤੁਸੀਂ ਲਗਾਤਾਰ ਸਾਈਕਲ ਚਲਾਉਂਦੇ ਰਹਿੰਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਅਤੇ ਤੁਹਾਡੇ ਸਰੀਰ ਲਈ ਬਹੁਤ ਚੰਗਾ ਬਣ ਜਾਂਦਾ ਹੈ ਤੁਸੀਂ ਲਗਾਤਾਰ ਜੇ ਲੰਬੇ ਰੂਟ ਉੱਤੇ ਅਤੇ ਸਾਈਕਲ ਚਲਾਉਂਦੇ ਰਹਿਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਮੈਂ ਉਹ ਵਿਅਕਤੀ ਜਿਹੜੇ ਬਹੁਤ ਲੰਬੇ ਲੰਬੇ ਰੂਟਾਂ ਉੱਤੇ ਪੂਰੇ ਭਾਰਤ ਦਾ ਚੱਕਰ ਵੀ ਸਾਈਕਲ ਉੱਤੇ ਲਗਾ ਦਿੰਦੇ ਹਨ ਉਹਨਾਂ ਨੂੰ ਦੇਖਦਾ ਸੁਣਦਾ ਅਤੇ ਪੜ੍ਹਦਾ ਰਹਿੰਦਾ ਹਾਂ ਜਿਸ ਨਾਲ ਮੈਨੂੰ ਲੰਬੇ ਰੂਟਾਂ ਉੱਤੇ ਜਾਣ ਦੇ ਲਈ ਵੀ ਪ੍ਰੇਰਨਾ ਮਿਲਦੀ ਰਹਿੰਦੀ ਹੈ